ਛੋਟੇ ਕਾਰੋਬਾਰ ਜਿਹੜੇ ਜਾਣ ਪਛਾਣ ਦੇ ਜੀ ਸਾਡੇ ਜਿਵੇਂ ਹੋ ਗਿਆ ਬੁਟੀਕ ਹੋ ਗਿਆ ਅਤੇ ਬਿਊਟੀ ਪਾਰਲਰ ਵਾਲਾ ਹੋ ਗਿਆ ਅਤੇ ਬੇਕਰੀ ਦਾ ਕੰਮ ਹੋ ਗਿਆ ਇਹ ਤਿੰਨ ਜਾਣ ਪਛਾਣ ਦੇ ਜ਼ਿਆਦਾ ਪਰ ਮੈਨੂੰ ਜ਼ਿਆਦਾ ਇੰਟਰਸਟ ਇਹਦੇ ਵਿੱਚ ਹੈ ਕਿ ਬੁਟੀਕ ਜੋ ਜ਼ਿਆਦਾ ਠੀਕ ਰਹਿੰਦੀ ਹੈਗੀ ਉਹਦੇ 'ਚ ਆਪਾਂ ਸਿਲਾਈ ਵੀ ਕਰ ਸਕਦੇ ਹਾਂ ਕਢਾਈ ਵੀ ਕਰ ਸਕਦੇ ਹਾਂ ਪੇਂਟਿੰਗ ਵੀ ਕਰ ਸਕਦੇ ਹੈਗੇ ਅਤੇ ਜਿਹਦੇ ਨਾਲ ਨਵੇਂ ਨਵੇਂ ਡਿਜ਼ਾਇਨ ਹੁੰਦੇ ਅਤੇ ਜ਼ਿਆਦਾ ਲੇਡੀਜ਼ ਨਵੇਂ ਡਿਜ਼ਾਇਨਾਂ ਨੂੰ ਜ਼ਿਆਦਾ ਪਸੰਦ ਕਰਦੀਆਂ ਨੇਗੀਆਂ ਅਤੇ ਉਹਦੇ ਵਿੱਚ ਬੈਨੀਫਿਟ ਵੀ ਜ਼ਿਆਦਾ ਗਾ ਅਤੇ ਉਹਦੇ ਵਿੱਚ ਅਸੀਂ ਆਪਾਂ ਵਿਆਹ ਸ਼ਾਦੀਆਂ ਦੇ ਲਈ ਵੀ ਸੂਟ ਤਿਆਰ ਕਰ ਸਕਦੇ ਹਾਂ ਆਮ ਕੋਈ ਖਾਸ ਪ੍ਰੋਗਰਾਮ ਆ ਉਹਦੇ ਲਈ ਵੀ ਅਤੇ ਆਮ ਸਿੰਪਲ ਘਰ ਡੇਲੀ ਵੀਅਰ ਵਾਲੇ ਵੀ ਕੱਪੜੇ ਯੂਜ ਕਰ ਸਕਦੇ ਆਂਗੇ ਅਤੇ ਉਹਦੇ ਵਿੱਚ ਆਪਾਂ ਅੱਗੇ ਵੀ ਕਾਰੋਬਾਰ ਚਲਾ ਸਕਦੇ ਹਾਂ ਜਿਵੇਂ ਕਿਸੇ ਨੂੰ ਟ੍ਰੇਨਿੰਗ ਵੀ ਦੇ ਸਕਦੇ ਹਾਂ ਉਹਦੇ ਨਾਲ ਅੱਗੇ ਵੀ ਕਿਸੇ ਨੂੰ ਰੁਜ਼ਗਾਰ ਮਿਲਦਾ ਹੈਗਾ ਅਤੇ ਨਾਲ ਆਪਾਂ ਨੂੰ ਇਹ ਹੋ ਜਾਂਦਾ ਕਿ ਆਪਾਂ ਕਿਸੇ ਅੱਗੇ ਵੀ ਕਿਸੇ ਦੇ ਅੱਗੇ ਹੱਥ ਕਰਨ ਯੋਗ ਨਹੀਂ ਰਹਿੰਦੇ ਆਪਣੇ ਆਪਾਂ ਆਪ ਖੁਦ ਆਪਣੇ ਪੈਰਾਂ ਉੱਪਰ ਖੜ੍ਹੇ ਹੋ ਸਕਦੇ ਹਾਂ ਆਪਾਂ ਆਪਣੇ ਬੱਚਿਆਂ ਦੀਆਂ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਹਾਂ ਕਈ ਵਾਰ ਆਪਣੇ ਘਰੋਂ ਇੰਨੀ ਮਜ਼ਬੂਰੀ ਹੁੰਦੀ ਹੈ ਕਿ ਆਪਾਂ ਘਰ ਦੇ ਹਾਲਾਤ ਵੀ ਏ ਇਸ ਦੇ ਜ਼ਰੀਏ ਸੁਧਰ ਸਕਦੇ ਹੈਗੇ ਵੀ ਆਪਾਂ ਨੂੰ ਆਪਣੇ ਡੇਲੀ ਦੀਆਂ ਲੋੜਾਂ ਵੀ ਆਪਾਂ ਕਮਾ ਕੇ ਪੂਰੀਆਂ ਕਰ ਸਕਦੇ ਹੈਂਗੇ ਅਤੇ ਇਹਦੇ ਨਾਲ ਆਪਣਾ ਇੱਕ ਤਰ੍ਹਾਂ ਦਾ ਸ਼ੌਕ ਵੀ ਪੂਰਾ ਹੁੰਦਾ ਸਿਲਾਈ ਦਾ ਸ਼ੌਕ ਵੀ ਪੂਰਾ ਹੁੰਦਾ ਆਪਣਾ ਅਤੇ ਹੋਰ ਨਵੇਂ ਨਵੇਂ ਡਿਜ਼ਾਇਨ ਵੀ ਮਿਲਦੇ ਆ ਅਤੇ ਨਵੇਂ ਨਵੇਂ ਲੋਕਾਂ ਨਾਲ ਜਦੋਂ ਆਪਣਾ ਵਾਹ ਪੈਂਦਾ ਉਹ ਆਪਣੀ ਸ਼ ਦੁਕਾਨ 'ਤੇ ਆਉਂਦੇ ਹੈ ਅਤੇ ਆਪਾਂ ਨੂੰ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਗਾ ਅਤੇ ਆਪਾਂ ਨੂੰ ਸਿਖਾਉਣ ਨੂੰ ਵੀ ਮਿਲਦਾ ਅਤੇ ਆਪਾਂ ਨੂੰ ਸਿੱਖਣ ਨੂੰ ਵੀ ਬਹੁਤ ਕੁਛ ਮਿਲਦਾ ਉਹਨਾਂ ਤੋਂ